ਜੇਕਰ ਮੈਨੂੰ ਦੁਨੀਆ ਵਿੱਚ ਕਿਤੇ ਵੀ ਯਾਤਰਾ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਆਪਣੇ ਗਵਾਂਢੀ ਦੇਸ਼ ਪਾਕਿਸਤਾਨ ਵਿੱਚ ਜ਼ਰੂਰ ਜਾਣਾ ਚਾਹਾਂਗੀ ਕਿਉਂਕਿ ਮੈਂ ਇੱਕ ਪੰਜਾਬੀ ਹਾਂ ਅਤੇ ਇੱਕ ਪੰਜਾਬੀ ਨੂੰ ਪਾਕਿਸਤਾਨ ਨਾਲ਼ ਉੱਨਾਂ ਹੀ ਪਿਆਰ ਹੈ ਜਿੰਨਾ ਕਿ ਮੈਨੂੰ ਆਪਣੇ ਪੰਜਾਬ ਨਾਲ਼ ਕਿਉਂਕਿ ਪਾਕਿਸਤਾਨ ਭਾਰਤ ਦਾ ਇੱਕ ਛੋਟਾ ਭਰਾ ਹੀ ਮੰਨਿਆ ਜਾਂਦਾ ਹੈ ਸਾਡੇ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਅਤੇ ਇਤਿਹਾਸਿਕ ਸਥਾਨ ਹਨ ਜੋ ਕਿ ਸਾਤੋਂ ਵਿਛੜ ਚੁੱਕੇ ਹਨ ਜੋ ਕਿ ਪਾਕਿਸਤਾਨ ਵਿੱਚ ਹੀ ਰਹਿ ਗਏ ਹਨ ਅਤੇ ਮੈਨੂੰ ਉਹ ਕੁਛ ਦੇਖਣ ਦਾ ਜੇਕਰ ਮੌਕਾ ਮਿਲਦਾ ਹੈ ਤਾਂ ਮੈਂ ਉਹ ਮੌਕਾ ਕਦੇ ਨਹੀਂ ਗੁਆਵਾਂਗੀ ਅਤੇ ਮੈਂ ਪਾਕਿਸਤਾਨ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਦਾ ਕਿਲ੍ਹਾ ਲਾਹੌਰ ਰਾਵਲਪਿੰਡੀ ਹਰ ਜਗ੍ਹਾ 'ਤੇ ਉਹ ਘੁੰਮਣਾ ਚਾਹਵਾਂਗੀ ਅਤੇ ਹਰ ਜਗ੍ਹਾ ਦੇਖਣ ਦੇਖਣਾ ਚਾਹਾਂਗੀ ਇਸ ਤੋਂ ਇਲਾਵਾ ਮੈਂ ਨਨਕਾਣਾ ਸਾਹਿਬ ਵਿੱਚ ਮੱਥਾ ਟੇਕਣਾ ਚਾਹਾਂਗੀ ਅਤੇ ਉੱਥੇ ਗੁਰੂ ਨਾਨਕ ਸ ਦੇਵ ਜੀ ਦੇ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰਨਾ ਚਾਹਾਂਗੀ